ਹੈਲੋ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਆਪਣਾ ਬਲਜੀਤ ਸਿੰਘ ਬੋਲ ਰਿਹਾ ਤੁਸੀਂ ਬਰਾੜ ਰੈਸਟੋਰੈਂਟਲ ਤੋਂ ਬੋਲ ਰਹੇ ਹੋ ਅਤੇ ਸਰ ਮੈਂ ਆਪਣਾ ਖਾਣਾ ਆਰਡਰ ਕਰਨਾ ਸੀਗਾ ਮੇਰੇ ਬੇਟੇ ਦਾ ਜਨਮ ਦਿਨ ਹੈ ਅਸੀਂ ਹੈਗੇ ਆ ਪੰਦਰਾਂ ਵੀਹ ਜਣੇ ਜਿਹਦੇ ਵਿੱਚ ਸਾਨੂੰ ਆਪਣਾ ਦਾ ਦਾਲ ਰੋਟੀ ਅਤੇ ਵੈਜ ਮਿਕਸ ਵੈਜ ਮਿਲ ਜਾਏ ਸਾਨੂੰ ਅਤੇ ਉਹਦੇ ਵਿੱਚ ਕੋਈ ਸਲਾਦ ਵਗੈਰਾ ਨਾਲ ਭੇਜ ਦੇਣਾ ਅਤੇ ਮੇਰਾ ਜਿਹੜਾ ਪਿੰਡ ਹੈ ਇਹ ਝੂ ਝੂੰਬਾ ਹੈ ਅਤੇ ਜਿੱਥੋਂ ਹੋਏਗਾ ਤਿੰਨ ਚਾਰ ਕਿਲੋਮੀਟਰ ਤੁਸੀਂ ਮੈਨੂੰ ਪੈਸੇ ਦੱਸ ਦਿਓ ਤੁਹਾਡੇ ਆਪਣਾ ਕਿੰਨੇ ਬਣਦੇ ਆ ਸਾਰੇ ਦੇ ਆਪਣਾ ਕਿੰਨੀ ਪਰ ਪਲੇਟ ਲਾਉਗੇ ਤੁਸੀਂ ਅਤੇ ਕੀ ਇਹਨਾਂ ਦਾ ਰੇਟ ਅਲੱਗ ਅਲੱਗ ਰੇਟ ਦਾ ਮੈਨੂੰ ਦਸ ਦਿਓ ਕੀ ਰੇਟ ਇਹਨਾਂ ਦਾ ਅਤੇ ਆਪਣਾ ਤੁਸੀਂ ਕਿੰਨੇ ਟਾਈਮ ਤੱਕ ਮੇਰੇ ਤੱਕ ਪਹੁੰਚਾ ਸਕਦੇ ਹੋ ਅਤੇ ਜਿਹੜੀ ਪੇਮੈਂਟ ਉਹ ਦੱਸ ਦਿਓ ਮੈਂ ਤੁਹਾਨੂੰ ਔਨਲਾਈਨ ਪੇਮੈਂਟ ਕਰ ਦਿੰਦਾ ਇਹਦੀ